ਹੈਲੋ ਹਾਂਜੀ ਹਾਂਜੀ ਮੈਂ ਨਾ ਬਾਗਾ ਬੋਡਰ ਦੇਖਣਾ ਅਤੇ ਤੁਸੀਂ ਮੈਨੂੰ ਗਾਈਡ ਕਰੋਗੇ ਕਿੱਦਾਂ ਜਾਣਾ ਉੱਥੇ ਕਿੱਦਾਂ ਮਤਲਬ ਲੈ ਕੇ ਜਾ ਸਕਦੇ ਹੋ ਕੀ ਦਿਖਾ ਸਕਦੇ ਉੱਥੇ ਹਾਂਜੀ ਹਾਂਜੀ ਅੰਮ੍ਰਿਤਸਰ ਗੋਲਡਨ ਟੈਂਪਲ ਹਾਂਜੀ ਹਾਂਜੀ

ਨਹੀਂ ਪਰ ਤੁਸੀਂ ਤੁਸੀਂ ਮੈਨੂੰ ਦੱਸੋਗੇ ਕਿੱਦਾਂ ਮਤਲਬ ਕਰੋਗੇ ਕੀ ਉੱਥੇ ਹੁੰਦਾ ਬਾਗਾ ਸੇਰਮਨੀ 'ਚ ਉਹਦੇ ਬਾਰੇ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਅਤੇ ਇਹ ਅਤੇ ਇਹ ਕਿੱਦਾਂ ਮਤਲਬ ਕਿੰਨਾ ਟਾਈਮਿੰਗ ਕੀ ਹੈਗੀ ਉੱਥੇ ਜਾਣ ਦੀ ਕਿ ਜਦੋਂ ਅਸੀਂ ਪੂਰੀ ਸੇਰਮਨੀ ਦੇਖ ਲਈਏ ਅੱਛਾ ਘੰਟਾ ਡੇਢ ਘੰਟਾ ਲੱਗ ਜਾਂਦਾ ਤਾਂ ਸਾਡੇ ਕੋਲੋਂ ਦਰਬਾਰ ਸਾਹਿਬ ਤੋਂ ਬਾਅਦ ਪੋਸੀਬਲ ਹੋ ਜਾਏਗਾ ਸਾਨੂੰ ਉੱਥੇ ਜਾਣਾ ਹਾਂ ਹਾਂ ਤੇ ਪੰਜ ਵਜੇ ਤੱਕ ਹੁੰਦੀ ਹੈ ਕਿਸੇ ਨੇ ਸਾਨੂੰ ਦੱਸਿਆ ਸੀ ਦਿਨ ਢਲਣ ਤੋਂ ਪਹਿਲੇ ਪਹਿਲੇ ਉੱਥੇ ਪਹੁੰਚਣਾ ਅੱਛਾ ਅੱਛਾ ਠੀਕ ਹੈ ਫਿਰ ਅਸੀਂ ਕੱਲ੍ਹ ਦਾ ਪ੍ਰੋਗਰਾਮ ਰੱਖੀਏ ਅਤੇ ਤੁਸੀਂ ਸਾਨੂੰ ਫਿਰ ਬਾਗਾ ਬਾ ਬੋਡਰ ਘੁਮਾ ਲਿਆਉਣਾ ਅਤੇ ਦੱਸ ਦੇਣਾ ਉੱਥੇ ਕੀ ਕੀ ਹੋਏਗਾ ਠੀਕ ਹੈ ਫਿਰ ਅਸੀਂ ਕੱਲ੍ਹ ਮਿਲਦੇ ਹਾਂ ਅਤੇ ਤੁਸੀਂ ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ ਠੀਕ ਹੈ ਜੀ ਥੈਂਕ ਯੂ ਜੀ ਓਕੇ ਸਤਿ ਸ਼੍ਰੀ ਅਕਾਲ